ਬਾਰ੍ਹਵੀਂ ਕਰਨ ਤੋਂ ਬਾਅਦ ਮੈਨੂੰ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲੈਣਾ ਸੀ ਜਿਵੇਂ ਕਿ ਮੈਂ ਬਹੁਤ ਹੀ ਵੱ ਵੱਡੀ ਸਮੱਸਿਆ ਵਿੱਚ ਸੀ ਕਿ ਮੈਂ ਬਾਰ੍ਹਵੀਂ ਤੋਂ ਬਾਅਦ ਅੱਗੇ ਕੀ ਕਰਾਂ ਅਤੇ ਮੇਰੀ ਇੱਕ ਸਕੂਲ ਅਧਿਆਪਕ ਨੇ ਮੇਰੀ ਇਸ ਵਿੱਚ ਬਹੁਤ ਹੀ ਮਦਦ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਿ ਤੈਨੂੰ ਅੱਗੇ ਇਸ ਫੀਲਡ ਵਿੱਚ ਜਾਣਾ ਚਾਹੀਦਾ ਹੈ ਅਤੇ ਤੈਨੂੰ ਇਹ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਮੈਂ ਉਹਨਾਂ ਦੇ ਕਹਿਣ 'ਤੇ ਇਹ ਮਹੱਤਪੂਰਨ ਫੈਸਲਾ ਲਿਆ ਕਿ ਮੈਂ ਅੱਗੇ ਬੀ ਸੀ ਏ ਕਰਨੀ ਹੈ ਜਿੱਦਾਂ ਕਿ ਬੀ ਸੀ ਏ ਵਿੱਚ ਕੰਪਿਊਟਰ ਬਾਰੇ ਪੂਰੀ ਜਾਣਕਾਰੀ ਹੈ ਅਤੇ ਕੰਪਿਊਟਰ ਦੀ ਹਰ ਇੱਕ ਲੈਂਗੁਏਜ਼ ਦੀ ਜਾਣਕਾਰੀ ਹੈ ਸਾਨੂੰ ਇਹ ਕੋਰਸ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਇਸ ਵਿੱਚ ਕੰਪਿਊਟਰ ਬਾਰੇ ਅਤੇ ਵੱਡੀਆਂ ਵੱਡੀਆਂ ਲੈਂਗੁਏਜ਼ਾਂ ਅਤੇ ਹਰ ਇੱਕ ਭਾਸ਼ਾ ਦੇ ਬਾਰੇ ਪਤਾ ਲੱਗਦਾ ਹੈ ਅਤੇ ਸਾਨੂੰ ਔਨਲਾਈਨ 'ਤੇ ਡੀਟੇ ਔਨਲਾਈਨ ਡਿਟੇਲਸ ਭਰਨੀਆ ਔਨਲਾਈਨ ਕੰਮ ਕਰਨਾ ਔਨਲਾਈਨ ਸ਼ੌਪਿੰਗ ਕਰਨਾ ਔਨਲਾਈਨ ਹਰ ਇੱਕ ਚੀਜ਼ ਬਣਾਉਣ ਦੇ ਬਾਰੇ ਪਤਾ ਲੱਗਦਾ ਹੈ ਇਸ ਫੀਲਡ ਵਿੱਚ ਅਤੇ ਇਸ ਕੋਰਸ ਵਿੱਚ ਮੈਨੂੰ ਬਹੁਤ ਹੀ ਵਧੀਆ ਵਧੀਆ ਤਰੀਕਿਆਂ ਬਾਰੇ ਪਤਾ ਲੱਗਿਆ ਕਿ ਮੈਂ ਕਿਵੇਂ ਔਨਲਾਈਨ ਕੰਮ ਕਰ ਸਕਦੀ ਹਾਂ ਕਿੱਦਾਂ ਮੈਂ ਕੰਪਿਊਟਰ ਦੀ ਮਦਦ ਨਾਲ ਆਪਣਾ ਹਰ ਇੱਕ ਕੰਮ ਘਰ ਬੈਠੇ ਬੈਠੇ ਕਰ ਸਕਦੀ ਹਾਂ ਅਤੇ ਕਿੱਦਾਂ ਮੈਂ ਇੱਕ ਵਧੀਆ ਬਿਜ਼ਨਸਮੈਨ ਬਿਜ਼ਨਸ ਵੂਮੈਨ ਬਣ ਸਕਦੀ ਹਾਂ ਅਤੇ ਕਿੱਦਾਂ ਮੈਂ ਕੰਪਿਊਟਰ ਦੀ ਮਦਦ ਨਾਲ ਦੂਜਿਆਂ ਨੂੰ ਅਤੇ ਆਪਣੇ ਆਪ ਨੂੰ ਕਿੱਦਾਂ ਹਰ ਕੰਮ ਵਿੱਚ ਕਿ ਹਰ ਇੱਕ ਕੰਮ ਵਿੱਚ ਕਿੱਦਾਂ ਰੁਝਾ ਸਕਦੀ ਹਾਂ ਇਸ ਨਾਲ ਇਸ ਫੀਲਡ ਵਿੱਚ ਆਉਣ ਨਾਲ ਮੈਨੂੰ ਬਹੁਤ ਹੀ ਫਾਇਦਾ ਹੋਇਆ ਹੈ ਇੱਕ ਮੈਨੂੰ ਕੰਪਿਊਟਰ 'ਤੇ ਕੰਮ ਕਰਨ ਦਾ ਪਤਾ ਲੱਗਿਆ ਹੈ ਅਤੇ ਕਿੱ ਮੈਂ ਕਿੱਦਾਂ ਅੱਗੇ ਆਪਣੇ ਕੰਮ ਨੂੰ ਘਰ ਬਹਿ ਕੇ ਕਰਨਾ ਹੈ ਅਤੇ ਕਿੱਦਾਂ ਆਪਣੀ ਆਪਣੇ ਫੀਲਡ ਨੂੰ ਅੱਗੇ ਲੈ ਕੇ ਜਾਣਾ ਹੈ ਮੈਨੂੰ ਇਸ ਬਾਰੇ ਪਤਾ ਲੱਗਿਆ ਇਹ ਮੇਰੀ ਮੇਰੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਸੀ